ਮੌਜੂਦਾ ਸਮਾਂ ਦੇ ਅਗਰ ਆਪਾਂ ਗੱਲ ਕਰੀਏ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੋਲੋ ਕਰਦਾ ਅਤੇ ਉਹਨਾਂ ਦੇ ਹੀ ਆਗਿਆ ਲੈ ਕੇ ਜੋ ਵੀ ਕੋਈ ਕੰਮ ਕਰਨਾ ਹੁੰਦਾ ਉਹ ਕਰੀਦਾ ਹੈ ਔਰ ਸਵੇਰੇ ਸ਼ਾਮ ਨਿਤਨੇਮ ਬਾਣੀਆਂ ਦਾ ਪਾਠ ਕਰਦੇ ਹਾਂ ਔਰ ਉਹਨਾਂ ਦੇ ਬਾਰੇ ਜੋ ਵੀ ਬਰੀਕੀ ਦੇ ਵਿੱਚ ਗਹਿਰਾਈਆਂ ਦੇ ਵਿੱਚ ਕੁਛ ਵਰਡ ਹੈ ਜਿਹੜੇ ਮੈਨੂੰ ਨਹੀਂ ਪਤਾ ਲੱਗਦੇ ਹਨ ਜਦੋਂ ਨੂੰ ਹੀ ਵਿਚਾਰਦਿਆਂ ਦੀ ਉਹਨਾਂ ਦੇ ਤਾਂ ਉਹ ਉਹ ਮੇਰਾ ਇੱਕ ਫਰੈਂਡ ਸਰਕਲ ਦੇ ਵਿੱਚ ਹੀ ਮੇਰਾ ਦੋਸਤ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਆਕਰਨ ਬਾਰੇ ਕਾਫੀ ਨੌਲਜ ਰੱਖਦਾ ਹੈ ਅਤੇ ਉਹਨਾਂ ਤੋਂ ਹੀ ਮੈਂ ਸਿੱਖਦਾ ਹਾਂ ਅਰ ਮੈਂ ਉਹਨਾਂ ਨੂੰ ਆਪਣਾ ਐਜ ਏ ਦੋਸਤ ਵੀ ਮੰਨਦਾ ਔਰ ਆਪਣਾ ਅਧਿਆਤਮਿਕ ਅਧਿਆਪਕ ਵੀ ਮੈਂ ਉਹਨਾਂ ਨੂੰ ਵੀ ਮੰਨਦਾ ਹਾਂ